ਗਾਇਕੀ ਦੇ ਵਿੱਚ ਭਾਵਨਾਵਾਂ ਬਹੁਤ ਅਹਿਮ ਭੂਮਿਕਾ ਨਿਭਾਉਂਦੀਆਂ ਹਨ ਜਿਵੇਂ ਕਿ ਆਪਾਂ ਸਭ ਨੂੰ ਪਤਾ ਹੈ ਕਿ ਗਾਣੇ ਜਿਹੜੇ ਆ ਉਹ ਕਈ ਤਰ੍ਹਾਂ ਦੇ ਹੁੰਦੇ ਆ ਕਈ ਗਾਣੇ ਖੁਸ਼ੀ ਨੂੰ ਰੁ ਬਿਆਨ ਕਰਦੇ ਆ ਕਈ ਗਾਣੇ ਜਿਹੜੇ ਆ ਤੁਹਾਡੀ ਗਮੀ ਨੂੰ ਕਹਿ ਲਓ ਬਿਆਨ ਕਰਦੇ ਆ ਸੋ ਇਸ ਤਰੀਕੇ ਨਾਲ ਇਨਸਾਨ ਦੇ ਹਰ ਇੱਕ ਮਨ ਦੇ ਭਾਵਾਂ ਨੂੰ ਦਰਸਾਉਣ ਦੇ ਲਈ ਕੋਈ ਨਾ ਕੋਈ ਗਾਣਾ ਬਣਿਆ ਹੋਇਆ ਆਪਾਂ ਆਪਣੇ ਮਨ ਦੇ ਭਾਵਾਂ ਨੂੰ ਗਾਇਕੀ ਦੇ ਥਰੂ ਸਾਹਮਣੇ ਵਾਲੇ ਦੇ ਰੂਬਰੂ ਕਰ ਸਕਦੇ ਹਾਂ ਗਾਇਕੀ ਦੇ ਵਿੱਚ ਭਾਵਨਾਵਾਂ ਬੜੀ ਅਹਿਮ ਭੂਮਿਕਾ ਨਿਭਾਉਂਦੀਆਂ ਹਨ ਜਿਵੇਂ ਕਿ ਹੁਣ ਜੇ ਆਪਾਂ ਕਿਸੇ ਵਿਆਹ ਦੀ ਗੱਲ ਕਰ ਲਈਏ ਤਾਂ ਜਿਵੇਂ ਕੁੜੀ ਦੇ ਵਿਆਹ ਵੇਲੇ ਉਹਦੇ ਮਨ ਦੇ ਭਾਵਾਂ ਨੂੰ ਦਰਸਾਉਂਦੇ ਕਈ ਸੁਹਾਗ ਜਿਹੜੇ ਆ ਉਹ ਸਾਡੇ ਸੱਭਿਆਚਾਰ ਦੇ ਵਿੱਚ ਮਿਲਣਗੇ ਜੇ ਅਸੀਂ ਮੁੰਡੇ ਦੇ ਵਿਆਹ 'ਤੇ ਗੱਲ ਕਰੀਏ ਤਾਂ ਉਹਦੇ ਵਿਆਹ ਵਾਸਤੇ ਘੋੜੀਆਂ ਨਾਂ ਦੇ ਜਿਹੜੇ ਲੋਕ ਗੀਤ ਕਹਿ ਲਓ ਬਣੇ ਹੋਏ ਆ ਉਹਨਾਂ ਨੂੰ ਆਪਾਂ ਜਿਹੜਾ ਹੈ ਉਹ ਉਸ ਵੇਲੇ ਦਾ ਮਾਹੌਲ ਜਿਹੜਾ ਹੈ ਉਹ ਘੋੜੀਆਂ ਦੇ ਜ਼ਰੀਏ ਦਰਸਾਇਆ ਜਾਂਦਾ ਬੜੇ ਵਧੀਆ ਢੰਗ ਦੇ ਨਾਲ ਇਸ ਤਰੀਕੇ ਦੇ ਨਾਲ ਹੋਰ ਵੀ ਕਈ ਗਾਣੇ ਹੈਗੇ ਨੇ ਜਿਨ੍ਹਾਂ ਦੇ ਵਿੱਚ ਸਾਡੇ ਪੁਰਾਤਨ ਸੱਭਿਆਚਾਰ ਤੋਂ ਉੱਠੀਆਂ ਹੋਈਆਂ ਗੱਲਾਂ ਜਿਹੜੀਆਂ ਸੀ ਉਹ ਅਸੀਂ ਉਹਨਾਂ ਨੂੰ ਆਪਣੇ ਗੀਤਾਂ ਦੇ ਵਿੱਚ ਗਾਉਂਦੇ ਹਾਂ